ਸਾਡੇ ਘਰ ਬਿਜਲੀ ਚੌਵੀ ਘੰਟੇ ਹੀ ਆਉਂਦੀ ਹੈ ਕਈ ਵਾਰੀ ਇੱਦਾਂ ਹੋ ਜਾਂਦਾ ਹੈ ਮੌਸਮ ਚੇਂਜ ਕਰਕੇ ਜਿਵੇਂ ਗਰਮੀਆਂ 'ਚ ਜਦੋਂ ਲੋੜ ਜ਼ਿਆਦਾ ਵੱਧ ਜਾਂਦਾ ਆ ਤਾਂ ਕਰਕੇ ਕਈ ਵਾਰੀ ਇਹ ਇੱਕ ਦੋ ਘੰਟਿਆਂ ਲਈ ਬਿਜਲੀ ਬੰਦ ਕਰ ਦਿੰਦੇ ਨੇ ਅਤੇ ਉਸ ਦੌਰਾਨ ਕਾਫੀ ਔਖਾ ਹੁੰਦਾ ਕਿ ਜਿਵੇਂ ਇੱਕ ਤਾਂ ਗਰਮੀ ਬਹੁਤ ਹੁੰਦੀ ਹੈ ਉੱਪਰੋਂ ਪੱਖੇ ਏ ਸੀ ਕੁਛ ਨਹੀਂ ਚੱਲ ਰਿਹਾ ਹੁੰਦਾ ਅਤੇ ਹੋਰ ਉੱਥੇ ਜਿਵੇਂ ਰੋਟੀ ਬਣਾਉਣ 'ਚ ਕਾਫੀ ਦਿੱਕਤ ਆਉਂਦੀ ਹੈ ਜਿਵੇਂ ਪਸੀਨੇ 'ਚ ਉੱਥੇ ਗਰਮੀ ਲੱਗਦੀ ਹੈ ਕਿਚਨ 'ਚ ਖੜ੍ਹੇ ਹੋਏ ਵੀ ਅਤੇ ਹੋਰ ਸਰਦੀਆਂ ਦੇ ਮੌਸਮ 'ਚ ਤਾਂ ਬਿਜਲੀ ਮਤਲਬ ਕਾਫੀ ਘੱਟ ਜਾਂਦੀ ਹੈ ਅਗਰ ਜਾਂਦੀ ਵੀ ਹੈ ਤਾਂ ਛੇਤੀ ਆ ਜਾਂਦੀ ਹੈ ਵਾਪਸ ਅਤੇ ਇੱਕ ਬਾਰਿਸ਼ਾਂ ਦੇ ਮੌਸਮ 'ਚ ਬਿਜਲੀ ਬਹੁਤ ਜ਼ਿਆਦਾ ਘੱਟ ਦਿੰਦੇ ਨੇ ਪਿੱਛੋਂ ਹੀ ਬੰਦ ਕਰ ਦਿੰਦੇ ਨੇ ਤਾਂ ਕਿ ਅੱਗੇ ਕੋਈ ਬਾਰਿਸ਼ ਜਾਂ ਅਗਰ ਹਵਾ ਚੱਲ ਰਹੀ ਹੋਵੇ ਤੇਜ਼ ਤਾਂ ਅੱਗੇ ਕੋਈ ਸ਼ਾਰਟ ਸਰਕਿਟ ਵਗੈਰਾ ਨਾ ਹੋਵੇ ਜਿਵੇਂ ਕਿ ਮਹੀਨੇ ਕੁ ਪਹਿਲਾਂ ਦੀ ਗੱਲ ਹੈ ਅਸੀਂ ਸਾਰੇ ਇੱਥੇ ਹੀ ਸੀਗੇ ਅਤੇ ਇੱਥੇ ਬਿਜਲੀ ਕੱਟ ਗਈ ਹਵਲ ਜਿੱਥੇ ਬਾਰਿਸ਼ ਆਈ ਤੂਫਾਨ ਆਇਆ ਉਹਤੋਂ ਘੰਟੇ ਕੁ ਪਹਿਲਾਂ ਹੀ ਇਹਨਾਂ ਨੇ ਬਿਜਲੀ ਕੱਟ ਦਿੱਤੀ ਤਾਂ ਕਿ ਇਹ ਜਿਹੜਾ ਸ਼ੋਟ ਸਰਕਟ ਆ ਉਹ ਤੋਂ ਬਚਣ ਲਈ ਕਿ ਕੱਲ੍ਹ ਨੂੰ ਕੋਈ ਨੁਕਸਾਨ ਨਾ ਹੋ ਜਾਏ ਹਵਾ ਚੱਲਣ ਦੇ ਕਾਰਨ ਅਤੇ ਧੰਨਵਾਦ